ਅੱਜ ਦੇ ਟਾਈਮ ਵਿੱਚ ਜੇਕਰ ਕਿਸੇ ਵਿਅਕਤੀ ਨੇ ਚੰਗਾ ਜੀਵਨ ਬਤੀਤ ਕਰਨਾ ਹੈ ਤਾਂ ਉਸਨੂੰ ਜਾਂ ਤਾਂ ਆਪਣਾ ਕਾਰੋਬਾਰ ਸੈੱਟ ਕਰਨਾ ਪਵੇਗਾ ਜਾਂ ਕੋਈ ਚੰਗੀ ਨੌਕਰੀ ਲੱਭਣੀ ਪਵੇਗੀ ਜੇਕਰ ਆਪਾਂ ਗੱਲ ਕਰੀਏ ਕਾਰੋਬਾਰ ਦੀ ਕਾਰੋਬਾਰ ਵਿੱਚ ਤਕਨੀਕ ਦਾ ਹੋਣਾ ਕਿੰਨਾ ਕੁ ਜਰੂਰੀ ਹੈ ਕਾਰੋਬਾਰ ਦੇ ਵਿੱਚ ਮੇਰੇ ਹਿਸਾਬ ਨਾਲ ਤਕਨੀਕ ਦਾ ਹੋਣਾ ਬਹੁਤ ਜਰੂਰੀ ਹੈ ਬਿਨਾਂ ਤਕਨੀਕ ਤੋਂ ਕਾਰੋਬਾਰ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਜੇਕਰ ਅਸੀਂ ਆਪਣੇ ਕਾਰੋਬਾਰ ਨੂੰ ਬਿਨਾਂ ਤਕਨੀਕ ਤੋਂ ਚਲਾਨ ਦੀ ਕੋਸ਼ਿਸ਼ ਕਰਾਂਗੇ ਤਾਂ ਹੋ ਸਕਦਾ ਹੈ ਕਿ ਅਸੀਂ ਅਸਫਲ ਰਹੀਏ ਇਸ ਕਰਕੇ ਸਾਨੂੰ ਕਾਰੋਬਾਰ ਕਰਨ ਤੋਂ ਪਹਿਲਾਂ ਤਕਨੀਕੀ ਚੀਜ਼ਾਂ ਉੱਪਰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਾਰੋਬਾਰ ਨੂੰ ਤਕਨੀਕੀ ਤਰੀਕੇ ਨਾਲ ਚਲਾਉਣ ਲਈ ਸਾਨੂੰ ਪਲਾਨਿੰਗ ਕਰਨੀ ਚਾਹੀਦੀ ਹੈ ਵੀ ਸਾਨੂੰ ਕੀ ਕਰੀਏ ਤਾਂ ਜੋ ਸਾਡਾ ਕਾਰੋਬਾਰ ਸਹੀ ਤਰੀਕੇ ਨਾਲ ਅੱਗੇ ਵਧੇ ਜੇਕਰ ਸਾਡਾ ਕਾਰੋਬਾਰ ਵਧੀਆ ਚੱਲੇਗਾ ਤਾਂ ਹੀ ਸਾਡਾ ਪਰਿਵਾਰ ਖੁਸ਼ ਰਹੇਗਾ ਕਾਰੋਬਾਰ ਨੂੰ ਚਲਾਉਣ ਦੇ ਲਈ ਸਾਨੂੰ ਤਕਨੀਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਕਨੀਕ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਚੱਲਦੀ ਖਾਸ ਕਰਕੇ ਕਾਰੋਬਾਰ ਕਾਰੋਬਾਰ ਤਕਨੀਕੀ ਤਰੀਕੇ ਨਾਲ ਚਲਾਣ ਲਈ ਸਾਨੂੰ ਵੈਲ ਪਲਾਨ ਬਣਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਕਾਰੋਬਾਰ ਸਹੀ ਚੱਲੇ